ਇੱਕ ਚਾਰ ਜਨਵਰੀ ਦੋ ਜ਼ੀਰੋ ਜ਼ੀਰੋ ਛੇ ਦੋ ਇੱਕ ਫਰਵਰੀ ਦੋ ਜ਼ੀਰੋ ਜ਼ੀਰੋ ਜ਼ੀਰੋ ਦੋ ਪੰਜ ਮਾਰਚ ਦੋ ਜ਼ੀਰੋ ਜ਼ੀਰੋ ਚਾਰ ਦੋ ਇੱਕ ਨਵੰਬਰ ਇੱਕ ਨੌਂ ਅੱਠ ਜ਼ੀਰੋ ਇੱਕ ਸੱਤ ਜੁਲਾਈ ਇੱਕ ਨੌਂ ਸੱਤ ਛੇ